ਭੰਗੜਾ ਐਰੋਬਿਕਸ ਦੇ ਬਾਰੇ ਲੋਕਾਂ ਵਿੱਚ ਗਲਤ ਧਾਰਨਾਵਾਂ ਇਹ ਹਨ ਕਿ ਭੰਗੜਾ ਜਿਹੜਾ ਹੈ ਔਰ ਐਰੋਬਿਕਸ ਜਿਹੜੀ ਹੈ ਉਹ ਸਿਰਫ਼ ਅਤੇ ਸਿਰਫ਼ ਇੱਕ ਫਿਜੀਕਲ ਐਕਟੀਵਿਟੀ ਹੈ ਸਿਰਫ਼ ਅਤੇ ਸਿਰਫ਼ ਇੱਕ ਐਗਜੋਸਟ ਕਰਨ ਵਾਲੀ ਐਕਟੀਵਿਟੀ ਹੈ ਜਦੋਂ ਕਿ ਨਹੀਂ ਭੰਗੜੇ ਔਰ ਐਰੋਬਿਕਸ ਦੇ ਨਾਲ ਬੰਦਿਆਂ ਦਾ ਸ਼ ਚੌਮੁੱਖਾ ਵਿਕਾਸ ਹੁੰਦਾ ਹੈ ਭੰਗੜਾ ਅਤੇ ਐਰੋਬਿਕਸ ਦੇ ਨਾਲ ਇਕੱਲਾ ਸਰੀਰਕ ਵਿਕਾਸ ਨਹੀਂ ਹੁੰਦਾ ਉਹਦੇ ਨਾਲ ਮਾਨਸਿਕ ਵਿਕਾਸ ਵੀ ਜ ਹੁੰਦਾ ਹੈ ਕਿਉਂਕਿ ਜਦੋਂ ਬੰਦਾ ਭੰਗੜਾ ਪਾਉਂਦਾ ਹੈ ਉਹਦੇ ਚਿਹਰੇ ਉੱਤੇ ਇੱਕ ਸਮਾਈਲ ਹੋਣੀ ਬਹੁਤ ਜ਼ਰੂਰੀ ਹੈ ਜਿਹੜੀ ਕਿ ਭੰਗੜੇ ਦੇ ਵਿੱਚ ਬੇਸਿਕ ਨੀਡ ਕਹੀ ਜਾਂਦੀ ਹੈ ਜਦੋਂ ਕਿ ਭੰਗੜਾ ਜਦੋਂ ਸਿਖਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਚਿਹਰੇ 'ਤੇ ਇੱਕ ਮੁਸਕਾਨ ਹੋਣੀ ਚਾਹੀਦੀ ਹੈ ਹਰ ਵੇਲੇ ਅਤੇ ਉਸ ਕਰਕੇ ਇਹ ਲੋਕਾਂ ਵਿੱਚ ਗਲਤ ਧਾਰਨਾ ਹੈ ਕਿ ਇਹ ਇਕੱਲੀ ਇੱਕ ਫਿਜੀਕਲ ਐਕਟੀਵਿਟੀ ਹੈ ਇਹ ਬੰਦਿਆਂ ਦੇ ਮਾਨਸਿਕ ਵਿਕਾਸ ਵਿੱਚ ਵੀ ਬਹੁਤ ਯੋਗਦਾਨ ਪਾਉਂਦੀ